ਵਿਦਿਆਰਥੀ ਨਿਯਮਤ ਤੌਰ ਉੱਤੇ ਇਸ ਕਰਕੇ ਸਕੂਲ ਨਹੀਂ ਜਾਂਦੇ ਕਿਉਂ ਕਰਕੇ ਭਾਰਤ ਦੀ ਜੋ ਵਿਵਸਥਾ ਹੈ ਉਹ ਇਸ ਵੇਲੇ ਬਿਲਕੁਲ ਗਰਕਦੀ ਜਾ ਰਹੀ ਹੈ ਵਿਦਿਆਰਥੀ ਪੜ੍ਹ ਲਿਖ ਜਾਂਦੇ ਹਨ ਪਰੰਤੂ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਸ ਕਾਰਨ ਉਹ ਧਰਨਿਆਂ ਉੱਤੇ ਬਹਿੰਦੇ ਹਨ ਜਾਂ ਫਿਰ ਵਿਹਲੇ ਹੋ ਕੇ ਨਸ਼ੇ ਵਿੱਚ ਪੈ ਜਾਂਦੇ ਹਨ ਜਾਂ ਹੋਰ ਬੁਰੀਆਂ ਲਾਹਮਤਾਂ ਉਹਨਾਂ ਨੂੰ ਆ ਘੇਰਦੀਆਂ ਹਨ ਜਦੋਂ ਪੜ੍ਹ ਲਿਖ ਕੇ ਵਿਦਿਆਰਥੀ ਲਗਾਤਾਰ ਇਸ ਤਰ੍ਹਾਂ ਖੱਜਲ ਖੁਆਰ ਹੋ ਰਹੇ ਹੁੰਦੇ ਹਨ ਤਾਂ ਛੋਟੇ ਵਿਦਿਆਰਥੀ ਉਹਨਾਂ ਨੂੰ ਦੇਖ ਕੇ ਇਸ ਕਾਰਨ ਸਕੂਲ ਨਹੀਂ ਜਾਂਦੇ ਕਿ ਪੜ੍ਹਾਈ ਦਾ ਇਸ ਦੇਸ਼ ਵਿੱਚ ਕੋਈ ਮੁੱਲ ਨਹੀਂ ਪੈਂਦਾ ਜਿਸ ਕਾਰਨ ਨਾ ਤਾਂ ਦੂਰੀ ਨਾ ਕੋਈ ਆਵਾਜਾਈ ਅਤੇ ਨਾ ਹੋਰ ਕਿਸੇ ਤਰ੍ਹਾਂ ਦੀ ਕੋਈ ਅੜਿੱਕਾ ਪੜ੍ਹਾਈ ਦੇ ਵਿੱਚ ਵਿਦਿਆਰਥੀਆਂ ਨੂੰ ਪੈਂਦਾ ਹੈ ਜੋ ਮੇਨ ਅੜਿੱਕਾ ਹੈ ਉਹ ਇਹੋ ਹੈ ਕਿ ਜਿਹੜੇ ਵਿਦਿਆਰਥੀ ਪੜ੍ਹ ਲਿਖ ਗਏ ਹਨ ਉਹਨਾਂ ਦੀ ਮਿਹਨਤ ਦਾ ਮੁੱਲ ਮੁੜੇ ਅਤੇ ਉਹਨਾਂ ਨੂੰ ਸਹੀ ਥਾਵਾਂ ਉੱਤੇ ਰੁਜ਼ਗਾਰ ਪ੍ਰਾਪਤ ਹੋ ਸਕੇ